ਮੈਂ ਆਪਣੇ ਦੋਸਤਾਂ ਨਾਲ ਘੁੰਮਣ ਫਿਰਨਾ ਬਹੁਤ ਪਸੰਦ ਕਰਦਾ ਹਾਂ ਮੈਂ ਘੁੰਮਣ ਲਈ ਆਪਣੇ ਦੋਸਤਾਂ ਨਾਲ ਚਿੰਤਪੁਰਨੀ ਵੀ ਗਿਆ ਸੀ ਅਤੇ ਮੈਨੂੰ ਬਹੁਤ ਹੀ ਮਜ਼ਾ ਆਇਆ ਅਤੇ ਮਾਤਾ ਦੇ ਦਰਸ਼ਨ ਕੀਤੇ ਚਿੰਤਪੁਰਨੀ ਜਾ ਕੇ ਮਾਤਾ ਦੇ ਦਰਸ਼ਨ ਤਾਂ ਹੋਏ ਹੋਏ ਅਤੇ ਆਪਣੇ ਦੋਸਤਾਂ ਨਾਲ ਵੀ ਬਹੁਤ ਸਾਰੀਆਂ ਗੱਲਾਂ ਸਾਂਝੀ ਕੀਤੀਆਂ ਅੱਜ ਦੇ ਦੌਰ ਦੇ ਵਿੱਚ ਜੋ ਸਮਾਂ ਚੱਲ ਰਿਹਾ ਮੈਨੂੰ ਲੱਗਦਾ ਕਿ ਸਾਨੂੰ ਮਿਲ ਜੁਲ ਕੇ ਇਕੱਠ ਦੇ ਵਿੱਚ ਜਾਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਟੈਂਸ਼ਨਾਂ ਘੱਟ ਹੋ ਸਕਣ ਅਤੇ ਪਰਿਵਾਰਿਕ ਗੱਲਾਂ ਸਾਂਝੀਆਂ ਹੋ ਸਕਣ ਅਤੇ ਪਰਿਵਾਰਿਕ ਗੱਲਾਂ ਸਾਂਝੀਆਂ ਹੋਣ ਦੇ ਨਾਲ ਬੰਦੇ ਦਾ ਜੋ ਸਟਰੈਸ ਹੈ ਉਹ ਘੱਟ ਜਾਂਦਾ ਹੈ ਘੁੰਮਣਾ ਫਿਰਨਾ ਮੈਨੂੰ ਲੱਗਦਾ ਹੈ ਕਿ ਆਪਣੇ ਦੋਸਤਾਂ ਨਾਲ ਜਾਂ ਆਪਣੇ ਰਿਸ਼ਤਾ ਰਿਸ਼ਤੇਦਾਰਾਂ ਨਾਲ ਜਾਂ ਆਪਣੇ ਮਾਂ ਪਿਓ ਜਾਂ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਜੋ ਸਾਨੂੰ ਇੱਦਾਂ ਲੱਗੇ ਕਿ ਸਾਡਾ ਪਰਿਵਾਰ ਅਤੇ ਸਾਡੇ ਮਾਂ ਪਿਓ ਸਾਡੇ ਭੈਣ ਭਰਾ ਸਾਡੇ ਦੋਸਤ ਰਿਸ਼ਤੇਦਾਰ ਸਾਡੇ ਨਾਲ ਹਨ ਅਤੇ ਅਸੀਂ ਉਹਨਾਂ ਨਾਲ ਸਮਾਂ ਬਤੀਤ ਕੀਤਾ ਹੈ ਸੋ ਘੁੰਮਣਾ ਫਿਰਨਾ ਇਕੱਠ ਦੇ ਵਿੱਚ ਹੀ ਹੋਵੇ ਤਾਂ ਬੜਾ ਵਧੀਆ ਮਹਿਸੂਸ ਹੁੰਦਾ ਹੈ